ਸਤਿ ਸ਼੍ਰੀ ਅਕਾਲ ਮੈਂ ਪ੍ਰਿਆ ਜੇਕਰ ਗੱਲ ਕੀਤੀ ਜਾਵੇ ਪਿੰਡਾਂ ਵਿੱਚ ਬਿਜ਼ਨਸ ਹਾਂ ਪਿੰਡਾਂ ਵਿੱਚ ਕਈ ਤਰ੍ਹਾਂ ਦੇ ਬਿਜ਼ਨਸ ਖੋਲ੍ਹੇ ਜਾ ਸਕਦੇ ਹਨ ਜਿਵੇਂ ਕਿ ਖੇਤੀਬਾੜੀ ਪਸ਼ੂ ਪਾਲਣ ਡਾਇਰੀ ਫਾਰਮ ਬਿਊਟੀ ਪਾਰਲਰ ਤੇ ਸਾਡੇ ਘ ਪਿੰਡ ਵਿੱਚ ਇਹ ਸਾਰੇ ਕੰਮ ਚੱਲਦੇ ਹਨ ਕਈ ਲੋਕਾਂ ਨੇ ਖੇਤੀਬਾੜੀ ਦਾ ਬਿਜ਼ਨੈਸ ਬੜੀਆਂ ਤਰੱਕੀਆਂ ਵਿਚ ਚੱਲ ਰਿਹਾ ਆ ਅਤੇ ਡੇਅਰੀ ਫਾਰਮ ਦੀ ਜਿਹੜੀਆਂ ਬੇਸਿਕ ਜ਼ਰੂਰਤਾਂ ਜਿਵੇਂ ਦੁੱਧ ਪਨੀਰ ਦਹੀ ਸਾਰ ਦੁੱਧ ਨਾਲ ਸਬੰਧਿਤ ਹੋਰ ਮਿਠਾਈਆਂ ਇਹ ਸਾਰੇ ਜਿਹੜੇ ਬਿਜਨਸ ਜਿਹੜੇ ਆ ਉਹ ਕੀਤੇ ਜਾ ਸਕਦੇ ਹਨ ਧੰਨਵਾਦ